ਹਾਂਜੀ ਮੇਰੇ ਕੋਲ ਇੱਕ ਕਿਤਾਬ ਆ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਉਹ ਕਿਤਾਬ ਨਹੀਂ ਕਹਿ ਸਕਦੇ ਇੱਕ ਟਰੈਕਟ ਆ ਛੋਟਾ ਟਰੈਕਟ ਪਿਆਰੇ ਦਾ ਪਿਆਰਾ ਉਹ ਕਿਤਾਬ ਬੜੀ ਪਿਆਰੀ ਆ ਉਹਦੇ ਵਿੱਚ ਵੈਸੇ ਤਾਂ ਉਹਦਾ ਜਿਹੜਾ ਵਿਸ਼ਾ ਅਧਿਆਤਮਿਕ ਆ ਧਾਰਮਿਕ ਆ ਉਹਦੇ ਵਿੱਚ ਇੱਕ ਜਗਿਆਸੂ ਸਿੱਖ ਆਪਣੇ ਗੁਰੂ ਪ੍ਰਤੀ ਕਿੰਨੀ ਸ਼ਰਧਾ ਰੱਖਦਾ ਗੁਰੂ ਦੇ ਪਿਆਰਿਆਂ ਪ੍ਰਤੀ ਕਿੰਨੀ ਸ਼ਰਧਾ ਰੱਖਦਾ ਕਿੰਨਾਂ ਵਿਸ਼ਵਾਸ ਹੈ ਉਹਦਾ ਉਸ ਸਾਰੀ ਵਾਰਤਾਲਾਪ ਦੇ ਵਿੱਚ ਇਸ ਗੱਲ ਦੀ ਪਰਪਕਤਾ ਹੈ ਅਤੇ ਉਹ ਕਿਤਾਬ ਰੂਹ ਨੂੰ ਸਕੂਨ ਦੇਣ ਵਾਲੀ ਆ ਉਹ ਕਿਤਾਬ ਕਿਉਂਕਿ ਕਿਤਾਬ ਕਿਉਂ ਪੜ੍ਹਦੇ ਹਾਂ ਇੱਕ ਤਾਂ ਕਿਤਾਬਾਂ ਪੜ੍ਹਦੇ ਹਾਂ ਅਸੀਂ ਗਿਆਨ ਲਈ ਕਿ ਆਪਾਂ ਗਿਆਨ ਹਾਸਲ ਕਰਨਾ ਕੁਝ ਕਿਤਾਬਾਂ ਗਿਆਨ ਲਈ ਜਾਂ ਸਮਝ ਡਿਵੈਲਪ ਕਰਨ ਦੇ ਲਈ ਨਹੀਂ ਕੁਝ ਕਿਤਾਬਾਂ ਰੂਹ ਨੂੰ ਸਕੂਨ ਦੇਣ ਦੇ ਲਈ ਪੜ੍ਹਨੀਆਂ ਹੁੰਦੀਆਂ ਨੇ ਪਿਆਰੇ ਦਾ ਪਿਆਰਾ ਭਾਈ ਵੀਰ ਸਿੰਘ ਜੀ ਦੁਆਰਾ ਲਿਖਿਆ ਹੋਇਆ ਟਰੈਕਟ ਰੂਹ ਨੂੰ ਸਕੂਨ ਦੇਣ ਵਾਲਾ ਹੀ ਇੱਕ ਟਰੈਕਟ ਹੈ ਇੱਕ ਕਿਤਾਬ ਹੈ ਜਿਹੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਅਤੇ ਮੈਂ ਜਿੰਨੇ ਵੀ ਮੇਰੇ ਸਰਕਲ ਦੇ ਵਿੱਚ ਜਾਂ ਮੇਰੇ ਲਿੰਕ ਦੇ ਵਿੱਚ ਜਿੰਨੇ ਵੀ ਦੋਸਤ ਮਿੱਤਰ ਨੇ ਜਾਂ ਜਿਹੜੇ ਨਵੇਂ ਵੀ ਜੁੜਦੇ ਨੇ ਤਾਂ ਮੈਂ ਹਮੇਸ਼ਾਂ ਕੋਸ਼ਿਸ਼ ਕਰਦਾ ਕਿ ਉਹ ਛੋਟਾ ਜਿਹਾ ਟਰੈਕਟ ਜਿਹੜਾ ਉਹ ਸਾਰੇ ਹੀ ਪੜ੍ਹਨ ਉਹਦੇ ਵਿੱਚ ਬਹੁਤ ਕਮਾਲ ਦੀ ਪੇਸ਼ਕਾਰੀ ਆ ਜਿਹੜੀ ਭਾਈ ਵੀਰ ਸਿੰਘ ਜੀ ਨੇ ਕੀਤੀ ਆ ਨਹੀਂ ਮੈਂ ਇਸ 'ਤੇ ਫਿਲਮ ਵੇਖਣਾ ਨਹੀਂ ਚਾਹਵਾਂਗਾ ਕਿਉਂਕਿ ਫਿਲਮ ਵੇਖ ਕੇ ਜਦੋਂ ਆਪਾਂ ਦ੍ਰਿਸ਼ ਦੇ ਨਾਲ ਜੁੜ ਜਾਂਦੇ ਹਾਂ ਅਤੇ ਉਦੋਂ ਕਿਤੇ ਨਾ ਕਿਤੇ ਸਾਡੇ ਅੰਦਰੋਂ ਜਿਹੜੀ ਅਸਲ ਭਾਵਨਾ ਜਿਹੜੀ ਪੜ੍ਹ ਕੇ ਜਿਹੜੀ ਸਾਡੀ ਕਲਪਨਾ ਨੇ ਬਖਸ਼ਣੀ ਹੁੰਦੀ ਆ ਉਹ ਸਾਡੀ ਮਨਫੀ ਹੋ ਜਾਂਦੀ ਆ ਇਸ ਕਰਕੇ ਮੈਂ ਕਦੇ ਵੀ ਨਹੀਂ ਚਾਹਵਾਂਗਾ ਕਿ ਅਜਿਹੇ ਟੋਪਿਕ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਫਿਲਮ ਜਾਂ ਪੜ੍ਹਦੇ 'ਤੇ ਇਹਦੀ ਪੇਸ਼ਕਾਰੀ ਕੀਤੀ ਜਾਵੇ